ਹੈਲੋ ਹਾਂਜੀ ਹਾਂਜੀ ਜੀ ਬੋਲਦੇ ਹਾਂ ਦੱਸੋ ਕਿਵੇਂ ਸੇਵਾ ਕਰ ਸਕਦੇ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਹਰ ਤਰ੍ਹਾਂ ਦੀ ਵਰਾਇਟੀ ਪਈ ਹੈ ਸਾਡੇ ਕੋਲ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਬਿਲਕੁਲ ਜੀ ਤੁਸੀਂ ਠੀਕ ਹੈ ਬਿਲਕੁਲ ਹਾਂਜੀ ਹਾਂਜੀ ਤੁਸੀਂ ਲੈਣੇ ਪਾਰਟੀਵੀਅਰ ਹੀ ਹੈ ਹਾਂਜੀ ਮੈਮ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਜਿਵੇਂ ਹੈ ਗਰਮੀ ਦਾ ਮੌਸਮ ਹੈ ਅਤੇ ਆਪਾਂ ਲੈਣੇ ਵੀ ਪਾਰਟੀਵੀਅਰ ਅਤੇ ਗਰਮੀ ਵੀ ਨਾ ਲੱਗੇ ਹਨਾ ਲੁੱਕ ਵਾਈਜ਼ ਅੱਛੇ ਲੱਗਣ 'ਤੇ ਤੁਸੀਂ ਮਸਲੀਨ ਕੋਟਨ ਵਗੈਰਾ 'ਚ ਟਰਾਈ ਕਰ ਸਕਦੇ ਹੋ ਅਤੇ ਉਹਦੇ ਵਿੱਚ ਸਾਡੇ ਕੋਲ ਕਾਫੀ ਵਾਈਡ ਰੇਂਜ ਹੈਗੀ ਹੈ ਅਤੇ ਉਹਦੇ ਵਿੱਚ ਮੈਂ ਕਢਾਈ ਵਾਲੇ ਲੈ ਸਕਦੇ ਹੋ ਤੁਸੀਂ ਹੈਂਡ ਵਰਕ ਵਾਲੇ ਵੀ ਪਏ ਆ ਸਾਡੇ ਕੋਲ ਕਾਫੀ ਕਲੈਕਸ਼ਨ ਹੈ ਕਲਰਸ ਦੀ ਕਾਫੀ ਕਲੈਕਸ਼ਨ ਹੈਗੀ ਹੈ ਅਤੇ ਉਹ ਮਸਲੀਨ ਕੋਟਨ ਟਰਾਈ ਕਰ ਸਕਦੇ ਹੋ ਤੁਸੀਂ ਅਤੇ ਇਸ ਤੋਂ ਇਲਾਵਾ ਕੋਟਨ 'ਚ ਵੀ ਕਾਫੀ ਅੱਛੀ ਵਰਾਈਟੀ ਪਈ ਏ ਹਾਂਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ

ਠੀਕ ਹੈ ਹਾਂਜੀ ਫੁਲਕਾਰੀਆਂ ਵੀ ਐਂ ਤੁਸੀਂ ਮੈਮ ਬਸ ਮੈਨੂੰ ਇੱਕ ਗੱਲ ਦੱਸ ਸਕਦੇ ਹੋ ਤੁਸੀਂ ਰੈਂਟ 'ਤੇ ਲੈਣਾ ਏ ਜਾਂ ਤੁਸੀਂ ਖਰੀਦਣਾ ਏ ਸਮਾਨ ਠੀਕ ਹੈ ਫੁਲਕਾਰੀ ਦੀ ਸਾਡੇ ਕੋਲ ਹਰ ਟਾਈਪ ਦੀਆਂ ਫੁਲਕਾਰੀਆਂ ਪਈਆਂ ਬਾਗ ਵੀ ਪਏ ਐਂ ਜੇ ਤੁਸੀਂ ਬਾਗ ਲੈਣਾ ਚਾਹੁੰਦੇ ਹੋ ਅਤੇ ਇਸ ਤੋਂ ਇਲਾਵਾ ਜਿਵੇਂ ਤੁਸੀਂ ਜਾਗੋ 'ਤੇ ਕਹਿ ਰਹੇ ਹੋ ਜਾਗੋ ਦੇ ਲਈ ਵੀ ਐਵੇਂ ਦੇ ਸੂਟ ਪਏ ਐਂ ਜਿਸ ਦੇ ਵਿੱਚ ਤੁਹਾਨੂੰ ਘੱਗਰੇ ਟਾਈਪ ਕੱਪੜਾ ਆ ਜੇਗਾ ਉਹਦੀ ਡੈਕੋਰੇਸ਼ਨ ਤੁਹਾਨੂੰ ਇੱਕ ਵਾਰੀ ਇਸ ਤਰ੍ਹਾਂ ਮਿਲ ਜਾਏਗੀ ਸੈਮੀ ਸਟਿੱਚ ਕਿ ਤੁਸੀਂ ਘੱਗਰਾ ਡਾਇਰੈਕਟ ਬਣਵਾ ਸਕਦੇ ਹੋ ਬਾਅਦ ਵਿੱਚ ਤੁਸੀਂ ਸਲਵਾਰ ਵੀ ਲੈ ਸਕਦੇ ਹੋ ਬਾਕੀ ਇਸ ਤਰ੍ਹਾਂ ਮੈਮ ਕਿ ਫੋਨ 'ਤੇ ਤਾਂ ਮੈਂ ਤੁਹਾਨੂੰ ਦੱਸ ਹੀ ਸਕਦੀ ਹਾਂ ਤੁਸੀਂ ਇੱਕ ਵਾਰੀ ਸਾਡੀ ਦੁਕਾਨ 'ਤੇ ਅ ਵਿਜਿਟ ਕਰੋ ਤੁਹਾਨੂੰ ਹਰ ਤਰ੍ਹਾਂ ਦੀ ਵਰਾਇਟੀ ਮਿਲੇਗੀ ਤੁਸੀਂ ਆਪ ਹੀ ਆਪਣੇ ਆਪਣੀ ਪਸੰਦ ਦਾ ਜੋ ਵੀ ਤੁਹਾਨੂੰ ਅੱਛਾ ਲੱਗਦਾ ਉਹਦੇ ਅਕੋਡਿੰਗ ਕਲੈਕਸ਼ਨ ਲੈ ਸਕਦੇ ਹੋ ਕੈਸ਼ ਔਨ ਡਿਲੀਵਰੀ ਵੀ ਹੈ ਮੈਮ ਪੇਮੈਂਟ ਦੇ ਸਾਡੇ ਕੋਲ ਸਾਰੇ ਮੈਥਡ ਹੈ ਜਿਵੇਂ ਤੁਹਾਨੂੰ ਗੂਗਲ ਪੇਟੀਐਮ ਇੰਟਰਨੈਟ ਬੈਂਕਿੰਗ ਜਾਂ ਕੈਸ਼ ਜਿਵੇਂ ਤੁਹਾਨੂੰ ਅੱਛਾ ਲੱਗਦਾ ਹੈ ਤੁਸੀਂ ਕਰ ਸਕਦੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਇੱਕ ਵਾਰੀ ਸ਼ੋਪ 'ਤੇ ਵੀ ਵਿਜ਼ਿਟ ਕਰ ਲਉ ਜੀ ਜੀ ਧੰਨਵਾਦ ਜੀ